ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੰਟਰਨੈਟ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਬੈਂਕਿੰਗ ਸੈਕਟਰ ਦੇ ਵਿੱਚ ਬੈਂਕਿੰਗ ਸੈਕਟਰ ਦੇ ਵਿੱਚ ਅੱਜ ਕੱਲ੍ਹ ਆਪਾਂ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਔਨਲਾਈਨ ਕਰਦੇ ਹਾਂ ਆਪਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਕਿ ਆਪਾਂ ਬੈਂਕ ਜਾਈਏ ਅਤੇ ਆਪਣੇ ਕੈਸ਼ ਨੂੰ ਅ ਜਮ੍ਹਾ ਕਰਾਈਏ ਜਾਂ ਫਿਰ ਉੱਥੋਂ ਵਿਦਡਰੋਅ ਕਰਾਈਏ ਜਿਹਦੇ ਨਾਲ ਕਿ ਆਪਣਾ ਟਾਈਮ ਵੀ ਵੇਸਟ ਹੁੰਦਾ ਵਾ ਬੈਂਕਸ ਦੇ ਵਿੱਚ ਇੱਕ ਫਿਕਸਡ ਟਾਈਮ ਹੁੰਦਾ ਵਾ ਕਿ ਜਦੋਂ ਆਪਾਂ ਜਾ ਸਕਦੇ ਹਾਂ ਆਪਣੇ ਕੰਮ ਕਰ ਸਕਦੇ ਹਾਂ ਬਟ ਜਿਹੜੀਆਂ ਔਨਲਾਈਨ ਟ੍ਰਾਂਜੈਕਸ਼ਨ ਆ ਉਹ ਆਪਾਂ ਘਰ ਬੈਠੇ ਕਦੋਂ ਵੀ ਜਦੋਂ ਮਰਜ਼ੀ ਕਰ ਸਕਦੇ ਹਾਂ ਕੋਈ ਟਾਈਮ ਫਿਕਸ ਨਹੀਂ ਹੁੰਦਾ ਇਹਦੇ ਨਾਲ ਕੀ ਆਪਣਾ ਆਉਣ ਜਾਣ ਦਾ ਸਮਾਂ ਵੀ ਬਚਦਾ ਆ ਆਪਣਾ ਆਉਣ ਜਾਣ ਦਾ ਖਰਚਾ ਵੀ ਬਚਦਾ ਆ ਜੋ ਕਿ ਬਹੁਤ ਹੀ ਵਧੀਆ ਹੈਗਾ ਵਾ ਇਸ ਦੇ ਲਈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬੈਂਕਸ ਨੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚਾਇਆ ਆ ਆਪਾਂ ਨੂੰ ਬਿਲਕੁਲ ਵੀ ਕੋਈ ਅ ਪ੍ਰੋਬਲਮ ਨਹੀਂ ਹੁੰਦੀ ਔਨਲਾਈਨ ਟਰਾਂਜੈਕਸ਼ਨ ਕਰਨ ਦੇ ਵਿੱਚ ਅੱਜ ਕੱਲ੍ਹ ਆਪਾਂ ਹਰ ਕੋਈ ਪੇਮੈਂਟ ਜਿਹੜੀ ਔਨਲਾਈਨ ਯੂ ਪੀ ਆਈ ਦੇ ਨਾਲ ਹੀ ਪੇਅ ਕਰ ਦਿੰਦੇ ਹਾਂ ਕੋਈ ਆਪਾਂ ਨੂੰ ਕੈਸ਼ ਕੈਰੀ ਨਹੀਂ ਕਰਨਾ ਪੈਂਦਾ ਅੱਜ ਕੱਲ੍ਹ ਬਹੁਤ ਸਾਰੇ ਚੋਰੀਆਂ ਹੁੰਦੀਆਂ ਜਦੋਂ ਆਪਾਂ ਜ਼ਿਆਦਾ ਜ਼ਿਆਦਾ ਕੈਸ਼ ਆਪਣੇ ਨਾਲ ਕੈਰੀ ਕਰਦੇ ਹਾਂ ਕਿਤੇ ਵੀ ਆਪਾਂ ਟਰੈਵਲ ਕਰਨਾ ਹੁੰਦਾ ਵਾ ਆਪਾਂ ਆਪਣੀ ਔਨਲਾਈਨ ਪੇਮੈਂਟ ਕਰਦੇ ਹਾਂ ਆਪਾਂ ਸ਼ੋਪਿੰਗ ਕਰਨੀ ਹੁੰਦੀ ਆ ਆਪਾਂ ਔਨਲਾਈਨ ਪੇਮੈਂਟ ਕਰਦੇ ਹਾਂ ਅੱਜ ਕੱਲ੍ਹ ਆਪਾਂ ਨੂੰ ਕੋਈ ਕੈਸ਼ ਕੈਰੀ ਨਹੀਂ ਕਰਨਾ ਪੈਂਦਾ ਕਿ ਆਪਾਂ ਕੋਈ ਚੀਜ਼ ਖਰੀਦਣੀ ਆ ਅਤੇ ਆਪਾਂ ਉਹਨੂੰ ਕੈਸ਼ ਪੇ ਕਰ ਕੈਸ਼ ਪੇਮੈਂਟ ਕਰੀਏ ਆਪਾਂ ਯੂ ਪੀ ਆਈ ਦੇ ਨਾਲ ਔਨਲਾਈਨ ਪੇਮੈਂਟ ਗੂਗਲ ਪੇ ਦੇ ਨਾਲ ਨਾਲ ਜਸਟ ਇੱਕ ਕਲਿੱਕ ਕਰਕੇ ਸਕੈਨ ਕਰਕੇ ਪੇਮੈਂਟ ਕਰ ਸਕਦੇ ਹਾਂ